ਕਸਰਤ ਕਰਨਾ ਆਪਣੇ ਸਰੀਰ ਲਈ ਬਹੁਤ ਹੀ ਵਧੀਆ ਚੀਜ਼ ਹੁੰਦੀ ਹੈ ਮੈਂ ਭੰਗੜਾ ਕਰਦਾ ਹਾਂ ਵੈਸਟਰਨ ਡਾਂਸ ਵੀ ਕਰਦਾ ਹਾਂ ਅਤੇ ਆਰੋਬਿਕਸ ਵੀ ਕਰਦਾ ਹਾਂ ਭੰਗੜਾ ਅਰੋ ਔਰੋਬੇਕਸ ਵਿੱਚ ਮੈਂ ਅਸੀਂ ਔਰ ਮੇਰੇ ਆਰੋਬਿਕਸ ਰੂਟੀਨ ਵਿੱਚ ਮੈਂ ਭੰਗੜੇ ਨੂੰ ਇੱਕ ਬਹੁਤ ਹੀ ਕੁਦਰਤੀ ਤਰੀਕੇ ਨਾਲ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ ਅਸੀਂ ਆਪਸ ਵਿੱਚ ਨੱਚਦੇ ਹਾਂ ਵਿਆਹਾਂ 'ਚ ਨੱਚਦੇ ਹਾਂ ਅਤੇ ਪਾਰਟੀਆਂ 'ਚ ਨੱਚਦੇ ਹਾਂ ਅਸੀਂ ਬਹੁਤ ਸਾਰੀ ਜਗ੍ਹਾ 'ਤੇ 'ਤੇ ਨੱਚਦੇ ਹਾਂ ਅਤੇ ਉਸ ਅਤੇ ਉੱਥੇ ਅਸੀਂ ਪੰਜਾਬੀ ਹੋਣ ਦੇ ਖਾਤਰ ਭੰਗੜਾ ਕਰਦੇ ਹਾਂ ਸਾਡੇ ਰੂਹਾਂ ਵਿੱਚ ਭੰਗੜਾ ਹੈਗਾ ਅਤੇ ਜਿੱਦਾਂ ਜਿੰਨਾ ਨੈਚਰਲ ਜਿੰਨਾ ਕੁਦਰਤੀ ਅਸੀਂ ਭੰਗੜੇ ਨੂੰ ਕਰਦੇ ਹਾਂ ਇਹ ਅਰੋਬਿਕਸ ਵਿੱਚ ਇਹ ਕਸਰਤ ਦਾ ਕੰਮ ਕਰਦਾ ਹੈ ਭੰਗੜਾ ਇੱਕ ਬਹੁਤ ਹੀ ਵਧੀਆ ਗਾਣੇ ਅਤੇ ਨੱਚਣ ਦਾ ਇੱਕ ਤਰੀਕਾ ਹੈ ਅਤੇ ਐਰੋਬਿਕਸ ਵਿੱਚ ਵੱਖਰੀਆਂ ਵੱਖਰੀਆਂ ਕਸਰਤਾਂ ਨਾ ਕਸਰਤਾਂ ਨਾਲ ਮੈਂ ਇਸ ਨੱਚਣ ਦੇ ਤਰੀਕੇ ਤੋਂ ਲੈ ਕੇ ਆਉਂਦਾ ਹਾਂ ਜਿਹਦੇ ਵਿੱਚ ਲੋਕਾਂ ਦਾ ਅਤੇ ਸਾਡਾ ਪਸੀਨਾ ਨਿਕਲੇ ਸਾਡੀ ਵਧੀਆ ਐਕਸਰਸਾਈਜ਼ ਹੋਵੇ ਜਿਹਦੇ ਥਰੂ ਅਸੀਂ ਕਾਫੀ ਕੁਛ ਸਾਡੀਆਂ ਬੋਡੀ ਲਚਕਦਾਰ ਬਣਦੀ ਹੈ ਤਾਕਤਵਰ ਬਣਦੀ ਹੈ ਅਤੇ ਸਾਨੂੰ ਭੁੱਖ ਲੱਗਦੀ ਹੈ ਇਸ ਭੁੱਖ ਨਾਲ ਅਸੀਂ ਜਦੋਂ ਖਾਣਾ ਖਾਂਦੇ ਹਾਂ ਤਾਂ ਸਾਡੀ ਪੂਰਾ ਸਰੀਰ ਸਾਡਾ ਪੂਰਾ ਸਰੀਰ ਵਧੀਆ ਬਣਦਾ ਹੈ ਮਾਸਪੇਸ਼ੀਆਂ ਡਿਵੈਲਪ ਹੁੰਦੀਆਂ ਹਨ